ਭੰਗੜਾ ਐਰੋਬਿਕਸ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬ ਵਿੱਚ ਪ੍ਰਸਿੱਧ ਹੋ ਗਿਆ ਹੈ ਇਹ ਸਿਰਫ ਇੱਕ ਮਜ਼ੇਦਾਰ ਗਤੀਵਿਧੀ ਨਹੀਂ ਬਲਕਿ ਇੱਕ ਬਹੁਤ ਹੀ ਵਧੀਆ ਕਸਰਤ ਵੀ ਹੈ ਅਤੇ ਮੇਰੇ ਜੀਵਨ ਵਿੱਚ ਵੀ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਮੈਂ ਸ਼ੁਰੂ ਤੋਂ ਹੀ ਬਹੁਤ ਸ਼ਰਮੀਲੀ ਕਿਸਮ ਦੀ ਇਨਸਾਨ ਸੀ ਅਤੇ ਲੋਕਾਂ ਨਾਲ ਮੇਰਾ ਜ਼ਿਆਦਾ ਮਿਲ ਜੁਲ ਨਹੀਂ ਸੀ ਪਰ ਜਦੋਂ ਦੀ ਮੈਂ ਭੰਗੜਾ ਐਰੋਬਿਕਸ ਕਲਾਸ ਵਿੱਚ ਦਾਖਲਾ ਲਿਤਾ ਹੈ ਉਦੋਂ ਤੋਂ ਹੀ ਮੇਰਾ ਹੌਂਸਲਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਤੇ ਇਹਦੇ ਬਹੁਤ ਸਾਰੇ ਫਾਇਦੇ ਵੀ ਹਨ ਇਹ ਸਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਸਾਡੇ ਮਨ ਨੂੰ ਵੀ ਸ਼ਾਂਤ ਕਰਦਾ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਹੀ ਬਜ਼ੁਰਗ ਔਰਤ ਜਿਹਦੇ ਗੋਡਿਆਂ ਵਿੱਚ ਦਰਦ ਰਹਿੰਦਾ ਸੀ ਉਹਨਾਂ ਨੇ ਸਾਡੇ ਭੰਗੜਾ ਐਰੋਬਿਕਸ ਕਲਾਸ ਵਿੱਚ ਦਾਖਲਾ ਲਿਤਾ ਸਮੇਂ ਦੇ ਨਾਲ ਉਹਨਾਂ ਦੇ ਗੋਡਿਆਂ ਦਾ ਦਰਦ ਵੀ ਘੱਟ ਹੋ ਗਿਆ ਅਤੇ ਉਹ ਬਹੁਤ ਜ਼ਿਆਦਾ ਖੁਸ਼ ਵੀ ਰਹਿਣ ਲੱਗ ਪਏ ਅਤੇ ਅਤੇ ਉਹਨਾਂ ਨੇ ਆਪਣੇ ਹੋਰ ਵੀ ਬਹੁਤ ਸਾਰੇ ਮਿੱਤਰਾਂ ਦਾ ਦਾਖਲਾ ਕਰਵਾਇਆ ਭੰਗੜਾ ਐਰੋਬਿਕਸ ਨੂੰ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਇਸ ਦੀ ਪ੍ਰਸਿੱਧੀ ਦਿਨੋਂ ਦਿਨ ਵਧਦੀ ਜਾ ਰਹੀ ਹੈ